ਅਸੀਂ ਵਿਆਹ ਵਿੱਚ ਕਈ ਤਰੀਕੇ ਨਾਲ ਆਨੰਦ ਮਨਾਉਂਦੇ ਹਨ ਸਭ ਤੋਂ ਪਹਿਲਾਂ ਅਸੀਂ ਮੁੰਡਾ ਅਤੇ ਕੁੜੀ ਨੂੰ ਮਿਲਦੇ ਹਨ ਜਿਹਨਾਂ ਦਾ ਵਿਆਹ ਹੋਣ ਵਾਲਾ ਹੈ ਅਤੇ ਉਹਨਾਂ ਨੂੰ ਆਪਣਾ ਆਸ਼ੀਰਵਾਦ ਦਿੰਦੇ ਹਨ ਉਹ ਤੋਂ ਬਾਅਦ ਅਸੀਂ ਉਹਨਾਂ ਦੇ ਮਾਪਿਆਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਮਿਲਦੇ ਹਨ ਉਹਨਾਂ ਦੇ ਨਾਲ ਬਹਿੰਦੇ ਹਨ ਥੋੜ੍ਹੀ ਬਹੁਤੀਆਂ ਗੱਲ ਬਾਤ ਗੱਲਾਂ ਬਾਤਾਂ ਕਰਦੇ ਹਨ ਅਤੇ ਉਸ ਤੋਂ ਬਾਅਦ ਅਸੀਂ ਆਪਦੇ ਸਾਰੇ ਇਸ਼ਤੇਦਾਰਾਂ ਦੇ ਨਾਲ ਮਿਲ ਕੇ ਮਿਠਾਈਆਂ ਖਾਂਦੇ ਹਨ ਉੱਥੇ ਕਈ ਸਾਰੇ ਸਨੈਕਸ ਉਪਲਬਧ ਹੁੰਦੇ ਹਨ ਜਿਵੇਂ ਕਿ ਡੋਸਾ ਪਾਓ ਭਾਜੀ ਕਈ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਜਿਹੜੀਆਂ ਆਪਾਂ ਚੱਖਦੇ ਹਨ ਖਾਂਦੇ ਹਨ ਅਤੇ ਉਹ ਤੋਂ ਬਾਅਦ ਅਸੀਂ ਡੀਜੇ 'ਤੇ ਸਾਥ ਨੱਚਦੇ ਵੀ ਹਨ ਅਤੇ ਕਈ ਤਰੀਕੇ ਨਾਲ ਅਸੀਂ ਖੁਸ਼ੀ ਆਪਣੀ ਸ਼ਾਂਝਾ ਕਰਦੇ ਹਨ ਇਸ ਤੋਂ ਬਾਅਦ ਕਈ ਸਾਰੇ ਸੰਗੀਤ ਹੁੰਦੇ ਹਨ ਜਿਹ 'ਤੇ ਅਸੀਂ ਡਾਂਸ ਕਰਦੇ ਹਨ ਜਿਹੜਾ ਸਾਨੂੰ ਵਧੀਆ ਵੀ ਲੱਗਦਾ ਹੈ ਜਿਵੇਂ ਕਿ ਦਿਲਜੀਤ ਦਾ ਗਾਣਾ ਮਨਕੀਰਤ ਔਲਖ ਦਾ ਗਾਣਾ ਸਤਿੰਦਰ ਸਰਤਾਜ ਦਾ ਗਾਣਾ ਐਂਵੇ ਕਈ ਜੇ ਗਾਣੇ ਗਾਣੇ ਹਨ ਜਿਹਦੇ 'ਤੇ ਅਸੀਂ ਨੱਚਣਾ ਪਸੰਦ ਕਰਦੇ ਹਨ ਅਤੇ ਜਿਹੜਾ ਸਾਰਿਆਂ ਨੂੰ ਨਚਾਉਂਦਾ ਹੈ ਅਤੇ ਸਾਨੂੰ ਬਹੁਤ ਹੀ ਖੁਸ਼ੀ ਮਹਿਸੂਸ ਕਰਾਉਂਦਾ ਹੈ